ਮੇਰੇ ਦੁਆਰਾ ਬਣਾਈ ਗਈ ਸਭ ਤੋਂ ਚੁਣੌਤੀਪੂਰਨ ਚਿੱਤਰਕਾਰੀ ਜਿਹੜੀ ਸੀਗੀ ਉਹ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾਉਣ ਵੇਲੇ ਮੈਂ ਜਦੋਂ ਸਾਰਾ ਕੁਛ ਬਣਾ ਲਿਆ ਪਰ ਮੈਥੋਂ ਅੱਖਾਂ ਸਹੀ ਨਹੀਂ ਸੀ ਬਣ ਰਹੀਆਂ ਕਿਉਂਕਿ ਅੱਖਾਂ ਆਮ ਇਨਸਾਨ ਦੀਆਂ ਅੱਖਾਂ ਬਣਾਉਣੀਆਂ ਬਹੁਤ ਸੌਖੀਆਂ ਨੇ ਪਰ ਜਦੋਂ ਗੁਰੂ ਨਾਨਕ ਦੇਵ ਜੀ ਦੀ ਕਿਸੇ ਪਹੁੰਚੇ ਹੋਏ ਰੱਬੀ ਰੂਪ ਰੂਪੀ ਬੰਦੇ ਦੀ ਤਸਵੀਰ ਬਣਾਉਣੀ ਹੋਵੇ ਤਾਂ ਅੱਖਾਂ ਵਿੱਚ ਜਿਹੜੀ ਭਗਤੀ ਸ਼ਰਧਾ ਸ਼ਾਂਤੀ ਦਿਖਾਉਣੀ ਹੁੰਦੀ ਹੈ ਉਹ ਬਹੁਤ ਔਖਾ ਕੰਮ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਅੱਖਾਂ ਬਣਾਉਣ ਵੇਲੇ ਮੈਨੂੰ ਸਭ ਤੋਂ ਵੱਧ ਚੁਣੌਤੀ ਇਸ ਗੱਲ 'ਚ ਲੱਗੀ ਕਿ ਉਹਨਾਂ ਦੀਆਂ ਅੱਖਾਂ ਓਨੀਆਂ ਵਧੀਆਂ ਨਹੀਂ ਸੀ ਬਣ ਰਹੀਆਂ ਜਿਹਦੇ ਨਾਲ ਉਹਨਾਂ ਦੇ ਵਿੱਚ ਸ਼ਾਂਤੀ ਦਿਖਾਈ ਜਾ ਸਕੇ ਅੱਖਾਂ ਇਸ ਤਰ੍ਹਾਂ ਬਣ ਜਾਂਦੀਆਂ ਸੀ ਜਿਵੇਂ ਉਹ ਗੁੱਸੇ 'ਚ ਹੋਣ ਜਾਂ ਅੱਖਾਂ ਇਸ ਤਰ੍ਹਾਂ ਬਣ ਜਾਂਦੀਆਂ ਸੀ ਜਿਸ ਤਰ੍ਹਾਂ ਉਹ ਹੈਰਾਨੀ ਵਿੱਚ ਹੋਣ ਪਰ ਸ਼ਾਂਤੀਪੂਰਨ ਅੱਖਾਂ ਬਣਾਉਣੀਆਂ ਬਹੁਤ ਚੁਣੌਤੀ ਲੱਗੀ ਮੈਨੂੰ ਇਸ ਕੰਮ ਲਈ ਮੈਨੂੰ ਘੱਟੋ ਘੱਟ ਇੱਕ ਹਫਤਾ ਲੱਗ ਗਿਆ ਮੈਂ ਬਾਰ ਬਾਰ ਅੱਖਾਂ ਨੂੰ ਦੁਬਾਰਾ ਦੁਬਾਰਾ ਬਣਾ ਰਿਹਾ ਸੀ ਅਤੇ ਬਹੁਤ ਹੀ ਮੁਸ਼ਕਿਲ ਨਾਲ ਆਖਰ ਨੂੰ ਮੈਂ ਇੰਨੀਆਂ ਵਧੀਆ ਅੱਖਾਂ ਉਹਨਾਂ ਦੇ ਬਣਾ ਹੀ ਲਈਆਂ ਜਿਹਨਾਂ ਵਿੱਚੋਂ ਸ਼ਾਂਤੀ ਝਲਕਦੀ ਸੀ ਮੈਂ ਇਸ ਅਨੁਭਵ ਤੋਂ ਇਹ ਸਿੱਖਿਆ ਕਿ ਕੋਈ ਵੀ ਤਸਵੀਰ ਬਣਾਉਣ ਤੋਂ ਪਹਿਲਾਂ ਉਹਦੇ ਬੈਕਗਰਾਉਂਡ ਬਾਰੇ ਜਿਸ ਦੀ ਆਪਾਂ ਤਸਵੀਰ ਬਣਾਉਣੀ ਹੈ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਜ਼ਰੂਰ ਲੈਣੀ ਚਾਹੀਦੀ ਹੈ ਅਤੇ ਰੰਗਾਂ ਦੀ ਮਿਕਸਿੰਗ ਕਰਨ ਦੀ ਟਕਨੀਕ ਪਹਿਲਾਂ ਤੋਂ ਹੀ ਸਿੱਖ ਲੈਣੀ ਚਾਹੀਦੀ ਹੈ ਕਿਉਂਕਿ ਰੰਗ ਮਿਕਸ ਕਰਕੇ ਜਦੋਂ ਤਸਵੀਰ 'ਚ ਭਰੇ ਜਾਂਦੇ ਹਨ ਤਾਂ ਜੇ ਤੁਹਾਨੂੰ ਪਹਿਲਾਂ ਪੁਰਾਣਾ ਤਜਰਬਾ ਨਹੀਂ ਹੈ ਤਾਂ ਤਸਵੀਰ ਖਰਾਬ ਹੋ ਸਕਦੀ ਹੈ ਪਹਿਲਾਂ ਰੰਗਾਂ ਨੂੰ ਮਿਕਸ ਕਰਕੇ ਉਹਨਾਂ ਨੂੰ ਕਿਸੇ ਹੋਰ ਪੇਜ 'ਤੇ ਬਾਰ ਬਾਰ ਟਰਾਈ ਕਰਕੇ ਦੇਖਣਾ ਚਾਹੀਦਾ ਹੈ ਤਾਂ ਕਿ ਜਿਹੋ ਜਿਹਾ ਰੰਗ ਆਪਾਂ ਤਸਵੀਰ ਵਿੱਚੋਂ ਉਭਾਰਨਾ ਹੈ ਉਸ ਤਰ੍ਹਾਂ ਦਾ ਰੰਗ ਆਪਣੇ ਕੋਲੇ ਤਾਂ ਬਣਾਉਣ ਦੀ ਮਹਾਰਤ ਪਹਿਲਾਂ ਹੀ ਹੋਵੇ ਇਸ ਕਰਕੇ ਮੈਂ ਚਿੱਤਰਕਾਰ ਦੇ ਇਸ ਅਨੁਭਵ ਤੋਂ ਇਹ ਸਿੱਖ ਲਿਆ ਹੈ ਕਿ ਪਹਿਲਾਂ ਮੈਨੂੰ ਰੰਗ ਮਿਕਸ ਕਰਨੇ ਸਿੱਖਣੇ ਪੈਣਗੇ ਜੋ ਕਿ ਬਹੁਤ ਹੀ ਪ੍ਰਪੱਕ ਹੋਣਾ ਜ਼ਰੂਰੀ ਹੈ ਬੰਦੇ ਦਾ ਉਸ ਤੋਂ ਬਾਅਦ ਕਿ ਜਿਸ ਦੀ ਵੀ ਤਸਵੀਰ ਬਣਾਉਣੀ ਹੈ ਉਸ ਦੇ ਹਰ ਇੱਕ ਅੰਗ ਬਾਰੇ ਉਸ ਦੇ ਹਿਸ ਇਤਿਹਾਸ ਬਾਰੇ ਆਪਾਂ ਨੂੰ ਚੰਗੀ ਤਰ੍ਹਾਂ ਜਾਣਕਾਰੀ ਹੋਵੇ ਕਿਉਂਕਿ ਗੁਰੂ ਸਾਹਿਬ ਦੀਆਂ ਅੱਖਾਂ ਬਣਾਉਣ ਵੇਲੇ ਤੁਹਾਨੂੰ ਸ਼ ਉਹਨਾਂ ਦੀਆਂ ਅੱਖਾਂ ਵਿੱਚ ਸ਼ਾਂਤੀ ਵੀ ਦਿਖਾਉਣੀ ਹੈ ਉਹਨਾਂ ਦੀਆਂ ਅੱਖਾਂ ਵਿੱਚ ਭਗਤੀ ਵੀ ਦਿਖਾਉਣੀ ਹੈ ਰੱਬ ਨਾਲ ਜੁੜੇ ਹੋਏ ਵੀ ਦਿਖਾਉਣੇ ਹੁੰਦੇ ਹਨ ਤਾਂ ਅੱਖਾਂ ਬਣਾਉਣੀਆਂ ਹੀ ਸਭ ਤੋਂ ਮੈਨੂੰ ਚੁਣੌਤੀਪੂਰਨ ਕੰਮ ਲੱਗਿਆ ਜੋ ਕਿ ਮੈਂ ਇੱਕ ਹਫਤੇ ਦੀ ਮਿਹਨਤ ਤੋਂ ਬਾਅਦ ਨੇਪਰੇ ਚਾੜ੍ਹ ਸਕਿਆ ਅਤੇ ਉਹਨਾਂ ਦੀਆਂ ਸ਼ਾਂਤੀਪੂਰਨ ਭਗਤੀ ਭਰੀਆਂ ਅੱਖਾਂ ਬਣਾਉਣ ਵਿੱਚ ਮੈਂ ਸਫਲ ਹੋਇਆ ਉਸ ਤੋਂ ਬਾਅਦ ਮੈਂ ਬਹੁਤ ਹੀ ਧਿਆਨ ਨਾਲ ਰੰਗ ਭਰ ਕੇ ਇੱਕ ਬਹੁਤ ਹੀ ਅੱਛੀ ਤਸਵੀਰ ਉਹਨਾਂ ਦੀ ਤਿਆਰ ਕੀਤੀ